ਹੈਲੋ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਮਾਨ ਰੈਸਟੋਰੈਂਟ ਤੋਂ ਬੋਲਦੇ ਹੋ ਮੈਂ ਤੁਹਾਡੇ ਰੈਸਟੋਰੈਂਟ ਦਾ ਇੱਕ ਡਿਲੀਵਰੀ ਬੋਆਏ ਹਾਂ ਮੇਰਾ ਨਾਂ ਗੁਰਪ੍ਰੀਤ ਸਿੰਘ ਹੈ ਅਤੇ ਮੇਰੇ ਨਾਲ ਦਾ ਜੋ ਮੁੰਡਾ ਸੀਗਾ ਉਹ ਵੀ ਇੱਕ ਡਿਲੀਵਰੀ ਬੋਆਏ ਨੇ ਅਤੇ ਉਨ੍ਹਾਂ ਨੇ ਜਿੰਨ੍ਹਾਂ ਤੋਂ ਜਿਹੜੇ ਕਸਟਮਰ ਤੋਂ ਆਡਰ ਲਿਆ ਸੀ ਉਹ ਉਨ੍ਹਾਂ ਦੀ ਕੌਲ ਨਹੀਂ ਚੁੱਕ ਰਹੇ ਅਤੇ ਮੈਂ ਉਨ੍ਹਾਂ ਨੂੰ ਕਾਫ਼ੀ ਟਾਈਮ ਤੋਂ ਹੀ ਕੌਲ ਕਰ ਰਹੇ ਨੇ ਅਤੇ ਉਹ ਮੇਰੀ ਵੀ ਕੌਲ ਨਹੀਂ ਪਿੱਕ ਕਰ ਰਹੇ ਅਤੇ ਉਹ ਕਸਟਮਰ ਜਿੰਨ੍ਹਾਂ ਤੋਂ ਉਨ੍ਹਾਂ ਨੇ ਓਡਰ ਲਿਆ ਸੀ ਉਹ ਵੀ ਕਾਫ਼ੀ ਟੈਮ ਤੋਂ ਮੈਨੂੰ ਹੀ ਕੌਲ ਰਹੇ ਨੇ ਅਤੇ ਜੇਕਰ ਉਨ੍ਹਾਂ ਦਾ ਓਡਰ ਨਾ ਪਹੁੰਚਿਆ ਤਾਂ ਉਹ ਕੰਪਲੇਟ ਵੀ ਕਰ ਸਕਦੇ ਨੇ ਅਤੇ ਤੁਸੀਂ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਨਾਲ ਉਨ੍ਹਾਂ ਨੂੰ ਕਹਿ ਦਿਓ ਕਿ ਉਹ ਮੇਰਾ ਵੀ ਕੌਲ ਚੁੱਕ ਲੈਣ ਅਤੇ ਉਹ ਕਸਟਮਰ ਨਾਲ ਵੀ ਗੱਲ ਕਰ ਲੈਣ ਜੋ ਵੀ ਉਨ੍ਹਾਂ ਦਾ ਓਡਰ ਹੈ ਉਨ੍ਹਾਂ ਤੱਕ ਪਹੁੰਚਾਇਆ ਜਾਵੇ ਕਸਟਮਰ ਵਾਰ ਵਾਰ ਕੌਲ ਕਰਕੇ ਮੈਨੂੰ ਹੀ ਤੰਗ ਕਰ ਰਹੇ ਨੇ ਕਿ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਕਹਿਣ ਕਿ ਸਾਡਾ ਓਡਰ ਜਲਦੀ ਤੱਕ ਆਵੇ ਜੇ ਉਹ ਓਡਰ ਨਾ ਪਹੁੰਚਿਆ ਤਾਂ ਉਹ ਕੰਪਲੇਂਟ ਕਰ ਦੇਣਗੇ ਰੈਸਟੋਰੈਂਟ ਦੇ ਖਿਲਾਫ ਤਾਂ ਰੈਸਟੋਰੇਂਟ ਦੀ ਬਦਨਾਮੀ ਵੀ ਹੋ ਸਕਦੀ ਹੈ ਅਤੇ ਉਹ ਉ ਪੁਲਿਸ ਵਗੈਰਾ ਵੀ ਆ ਸਕਦੀ ਹੈ ਰੈਸਟੋਰੈਂਟ ਤੱਕ ਅਤੇ ਰੈਸਟੋਰੈਂਟ ਦੀ ਬੇਇੱਜ਼ਤੀ ਹੋਵੇਗੀ ਓਨਰ ਦੀ ਵੀ ਬੇਇੱਜ਼ਤੀ ਹੋਵੇਗੀ